ਬਹੁਤ ਦੇਰ ਤੋਂ ਸਾਨੂੰ ਦੇਖਣ ਨੂੰ ਆ ਰਿਹਾ ਸੀ ਕੀ ਪੰਜਾਬ ਦੇ ਵਿੱਚ ਪੰਜਾਬੀ ਲੈਂਗੁਏਜ ਕਾਫੀ ਪਿਛੜ ਚੁੱਕਿਆ ਜਿਹਦੇ ਵਿੱਚ ਪ੍ਰਮੋਟ ਕਰਨ ਲਈ ਸਰਕਾਰ ਨੇ ਕਾਫੀ ਪ੍ਰਦਾਰ ਕੀਤੇ ਆ ਕਿਉਂਕਿ ਬੱਚੇ ਆਪਣੇ ਮਦਰ ਟੰਗ ਤੋਂ ਹੀ ਦੂਰ ਹੋ ਚੁੱਕੇ ਸੀ ਜਿਹਦੇ ਕਰਕੇ ਸਰਕਾਰ ਨੇ ਪੰਜਾਬੀ ਲੈਂਗੁਏਜ ਨੂੰ ਪੰਜਾਬੀ ਸਕੂਲਾਂ ਦੇ ਵਿੱਚ ਲਾਜ਼ਮੀ ਕੀਤਾ ਅਤੇ ਸਰਕਾਰੀ ਦਫਤਰਾਂ ਦੇ ਵਿੱਚ ਵੀ ਇਸ ਨੂੰ ਲਾਜ਼ਮੀ ਕੀਤਾ ਜਿਸ ਕਰਕੇ ਕਿ ਪੰਜਾਬ ਦੇ ਵਿੱਚ ਪੰਜਾਬੀ ਦੀ ਅਹਿਮੀਅਤ ਬੜੇ ਠੀਕ ਬਾਕੀ ਬਾਕੀ ਹੋਰ ਲੈਂਗੁਏਜ ਨਾਲ ਦੇਖੀਏ ਤਾਂ ਪੰਜਾਬ ਦੇ ਵਿੱਚ ਮੋਸਟਲੀ ਸਾਰੇ ਜਿਹੜੇ ਹੈਗੇ ਉਹ ਪੰਜਾਬੀ ਤੋ ਕਾਫੀ ਕਤਰਾ ਰਹੇ ਸੀਗੇ ਬੱਚਿਆ ਨੂੰ ਪੰਜਾਬੀ ਬੋਲਣ ਭੁੱਲ ਈ ਚੁੱਕੇ ਸੀਗੇ ਜਿਸ ਕਰਕੇ ਸਰਕਾਰ ਨੂੰ ਉਸ ਨੂੰ ਪ੍ਰਮੋਟ ਕਰਨ ਲਈ ਪੰਜਾਬੀ ਲੈਗੁਏਜ ਨੂੰ ਸਰਕਾਰੀ ਸਕੂਲ ਦੇ ਵਿਚ ਸਰਕਾਰੀ ਅਦਾਰੇ ਵਿਚ ਪੰਜਾਬੀ ਨੂੰ ਲਾਜਮੀ ਕੀਤਾ ਜਿਸ ਕਰਕੇ ਅਸੀਂ ਆਪਣੀ ਮਦਰ ਟੰਗ ਤੇ ਦੁਬਾਰਾ ਵਾਪਿਸ ਆ ਸਕੇ ਹਾਂ ਤੇ ਇਸ ਨੂੰ ਪ੍ਰਮੋਟ ਕਰਨ ਲਈ ਸਾਨੂੰ ਸਹਿਯੋਗ ਕਰਨਾ ਚਾਹੀਦਾ ਹੈ ਤੇ ਪੰਜਾਬ ਲਈ ਸ਼ੁਕਰ ਗੁਜ਼ਾਰ ਹੈ ਜਿਵੇਂ ਪੰਜਾਬੀ ਲੈਗੁਏਜ ਮਦਰ ਟੰਗ ਨੂੰ ਦੁਬਾਰਾ ਜੀਵਿਤ ਕਰਨ ਲਈ ਕੰਮ ਕਰ ਰਹੀ ਹੈ